ਮੈਂ ਵਿਜੈ ਗੁਰਦਾਸਪੁਰ ਜ਼ਿਲ੍ਹੇ ਦਾ ਵਾਸੀ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਕਈ ਪਿੰਡਾਂ ਜਾਂ ਸ਼ਹਿਰਾਂ ਨੂੰ ਸਿਹਤ ਸੰਭਾਲ ਆਵਾਜਾਈ ਅਤੇ ਸਿੱਖਿਆ ਦੇ ਹੋਰ ਬੁਨਿਆਦੀ ਲੋੜਾਂ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਕੁਝ ਪਿੰਡ ਅਜਿਹੇ ਹਨ ਜੋ ਕਿ ਸਿਹਤ ਸੰਭਾਲ ਦੇ ਪੱਖੋਂ ਬੜੇ ਹੀ ਵਾਂਝੇ ਹਨ ਉਹਨਾਂ ਪਿੰਡਾਂ ਵਿੱਚ ਕੁਝ ਸਿਹਤ ਸਹੂਲਤਾਂ ਦੀ ਘਾਟ ਹੈ ਜੋ ਕਿ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਜੇਕਰ ਦੂਜੇ ਨੰਬਰ ਦੀ ਗੱਲ ਕਰਾਂ ਤਾਂ ਆਵਾਜਾਈ ਦੀ ਲੋਕਾਂ ਨੂੰ ਬੜੀ ਹੀ ਦਿੱਕਤ ਹੈ ਕੁਝ ਅਜਿਹੇ ਪਿੰਡ ਸਾਡੇ ਇਲਾਕੇ ਵਿੱਚ ਮੌਜੂਦ ਹਨ ਜਿੱਥੇ ਨਾ ਕੋਈ ਆਟੋ ਰਿਕਸ਼ਾ ਨਾ ਕੋਈ ਘੋੜਾ ਨਾ ਕੋਈ ਇਹ ਰਿਕਸ਼ਾ ਆ ਜੀ ਮਿਲਦਾ ਹੈ ਲੋਕਾਂ ਨੂੰ ਆਪੋ ਆਪਣੇ ਸਾਧਨਾਂ 'ਤੇ ਘਰਾਂ 'ਚੋਂ ਨਿਕਲ ਕੇ ਅਤੇ ਸ਼ਹਿਰਾਂ ਵਿੱਚ ਭੱਜਣਾ ਪੈਂਦਾ ਹੈ ਜਾਂ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਪਿੰਡਾਂ ਵਿੱਚ ਅਜੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਘਾਟ ਹੈ ਜੋ ਕਿ ਕਈ ਤਰ੍ਹਾਂ ਦੀਆਂ ਬੁਨਿਆਦੀ ਲੋੜਾਂ ਨੂੰ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਪਿੰਡਾਂ ਵਿੱਚ ਖਾਸ ਕਰਕੇ ਸਿਹਤ ਸਹੂਲਤਾਂ ਜਾਂ ਆਵਾਜਾਈ ਦੇ ਸਾਧਨਾਂ ਦੀ ਜਾਂ ਹੋਰ ਵਿੱਦਿਅਕ ਢਾਂਚੇ ਦੀ ਵਧੀਆ ਕਾਰਗੁਜ਼ਾਰੀ ਕਰਕੇ ਲੋਕਾਂ ਨੂੰ ਉਸ ਕਾਰਗੁਜ਼ਾਰੀ ਲਈ ਇਹ ਗੱਲ ਦਾ ਭਰੋਸਾ ਦੇਵੇ ਕਿ ਅਸੀਂ ਤੁਹਾਡੇ ਇਲਾਕੇ ਵਿੱਚ ਵਧੀਆ ਤੋਂ ਵਧੀਆ ਸਹੂਲਤ ਜਿਹੜੀ ਆ ਪ੍ਰਦਾਨ ਕਰਾਂਗੇ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਉਹ ਇਲਾਕੇ ਜਿਹੜੇ ਕਿ ਬੜੇ ਹੀ ਮਾੜੇ ਹਨ ਉਹਨਾਂ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਇਹ ਕਦਮ ਚੁੱਕਣ ਦੀ ਜ਼ਰੂਰਤ ਹੈ ਧੰਨਵਾਦ